ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਦੱਸਦੇ ਹਾਂ ਕਿੰਨਾ ਸਾਈਜ਼ ਅੱਛਾ ਹਾਂਜੀ ਭਾਅ ਜੀ ਕੀ ਹੋਇਆ ਕਿੱਦਾਂ ਕੰਪਨੀ ਦਾ ਇਹਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਟੇ ਕਿੱਦਾਂ ਭਾਅ ਜੀ ਇਹ ਜੁੱਤੇ ਤੁਸੀਂ ਬੋਲ ਰਹੇ ਨਾ ਫੱਟ ਗਏ ਹਨ ਫਟੇ ਕਿੱਦਾਂ ਹਾਂਜੀ ਅੱਛਾ ਕੋਈ ਨਹੀਂ ਆ ਜਾਇਓ ਤੁਸੀਂ ਦੁਕਾਨ 'ਤੇ ਆ ਜਿਓ ਇੱਕ ਵਾਰੀ ਦਿਖਾ ਲਿਓ ਜੁੱਤੇ ਬਾਕੀ ਚੇਂਜ ਹੋ ਜਾਣਗੇ ਹਾਂਜੀ ਹਾਂਜੀ ਹਾਂਜੀ ਉਹ ਤਾਂ ਸਾਈਜ਼ ਤੁਹਾਡੇ ਕਿੰਨਾ ਕਿਹਾ ਸੀ ਤੁਸੀਂ ਨੌਂ ਸਾਈਜ਼ ਨੌਂ ਸਾਈਜ਼ ਹੈਗਾ ਕੋਈ ਨਹੀਂ ਆ ਜਾਇਓ ਹਾਂਜੀ ਹਾਂਜੀ ਭਾਅ ਜੀ ਤੁਹਾਨੂੰ ਔਫਰ ਤੇ ਦਿੱਤਾ ਨਾ ਔਫਰ 'ਤੇ ਦਿੱਤੇ ਸੀ ਜੁੱਤੇ ਓ ਤੁਹਾਨੂੰ ਕਿੰਨੇ ਦਾ ਪਿਆ ਸੀ ਹਾਂਜੀ ਤੁਹਾਨੂੰ ਕਿੰਨੇ ਦੇ ਪਏ ਸਾਡੇ ਕੋਲੋਂ ਅਸੀਂ ਕਿੰਨੇ ਦੇ ਦਿੱਤੇ ਤੁਹਾਨੂੰ ਚਲੋ ਭਾਅ ਜੀ ਕੋਈ ਨਹੀਂ ਲੈ ਆਇਓ ਦੇਖ ਲਵਾਂਗੇ ਕਰ ਲਵਾਂਗੇ ਕੋਈ ਔਫਰ ਨਾਲ ਜੇ ਚੱਲ ਰਿਹਾ ਹੋਵੇਗਾ ਜੇ ਤ ਤੁਸੀਂ ਕੱਲ੍ਹ ਸ਼ਾਮ ਨੂੰ ਆ ਜਿਓ ਛੇ ਵਜੇ ਓਕੇ ਭਾਅ ਜੀ